ਮੈਨੂੰ ਆਪਣੇ ਕਾਲਜ ਦੀਆਂ ਅਸਾਈਨਮੈਂਟ ਪੂਰਾ ਕਰਨ ਲਈ ਆਪਣੇ ਇੱਕ ਟੈਬਲਟ ਦੀ ਜ਼ਰੂਰਤ ਸੀ ਕਿਉਂਕਿ ਮਤਲਬ ਕਿ ਫੋਨ ਉੱਤੇ ਜੇ ਅਸੀਂ ਆਪਣਾ ਪੂਰਾ ਕੰਮ ਕਰਦੇ ਹਾਂ ਤਾਂ ਮਤਲਬ ਕਿ ਉਹਦੇ 'ਤੇ ਬਹੁਤ ਹੀ ਜ਼ਿਆਦਾ ਨਿਗ੍ਹਾ ਲੱਗਦੀ ਹੈ ਅਤੇ ਟੈਬ 'ਤੇ ਕੰਮ ਕਰਨਾ ਸੌਖਾ ਹੋ ਜਾਂਦਾ ਅਤੇ ਮੇਰੇ ਕੋਲ ਜ਼ਿਆਦਾ ਬਜਟ ਵੀ ਨਹੀਂ ਨਹੀਂ ਸੀਗਾ ਅਤੇ ਫਿਰ ਮੈਂ ਨਾ ਆਪਾਂ ਇਹ ਮਤਲਬ ਕਿ ਆਨਲਾਈਨ ਵੈਬਸਾਈਟਸ 'ਤੇ ਚੈੱਕ ਕੀਤਾ ਕਿ ਮੈਨੂੰ ਕਿਤੋਂ ਸਸਤੀ ਟੈਬਲਟ ਮਿਲ ਜਾਵੇ ਜਿਹੜੀ ਮੇਰੀ ਬਜਟ ਦੇ ਵਿੱਚ ਵੀ ਹੋਵੇ ਮੈਂ ਮੋਸਟਲੀ ਦੋ ਵੈਬਸਾਈਟ ਯੂਜ ਕਰਦੀ ਹਾਂ ਇੱਕ ਫਲਿਪਕਾਰਟ ਅਤੇ ਇੱਕ ਐਮਾਜੋਨ ਅਤੇ ਉੱਥੇ ਬਹੁਤ ਮਹਿੰਗੀਆਂ ਮਹਿੰਗੀਆਂ ਟੈਬਲੇਟਸ ਸੀਗੀਆਂ ਅਤੇ ਫਿਰ ਮੇਰੀ ਨਿਗ੍ਹਾ ਲੀਨੋਵੋ ਟੈਬਲੇਟ 'ਤੇ ਪਈ ਲੀਨੋਵੋ ਮੇਰੀ ਬਜਟ ਦੇ ਵਿੱਚ ਵੀ ਸੀ ਮੈਂ ਦੋਨਾਂ ਪਾਸੇ ਚੈੱਕ ਕੀਤਾ ਐਮਜ਼ੋਨ 'ਤੇ ਜਦੋਂ ਮੈਂ ਚੈੱਕ ਕੀਤਾ ਅਤੇ ਉੱਥੇ ਉਹਦਾ ਰੇਟ ਥੋੜ੍ਹਾ ਜ਼ਿਆਦਾ ਸੀ ਅਤੇ ਕੋਈ ਇੰਨੀ ਗਰੰਟੀ ਵੀ ਨਹੀਂ ਸੀ ਦੇ ਰਹੇ ਅਤੇ ਫਿਰ ਮੈਂ ਉਹੀ ਫਲਿਪਕਾਰਟ 'ਤੇ ਜਾ ਕੇ ਚੈੱਕ ਕੀਤਾ ਅਤੇ ਉੱਥੇ ਮੈਨੂੰ ਪੰਜ ਸੌ ਰੁਪਏ ਸਸਤਾ ਮਿਲ ਰਿਹਾ ਸੀ ਅਤੇ ਫਿਰ ਮੈਂ ਆਪਣਾ ਮਤਲਬ ਕਿ ਉੱਥੋਂ ਫਲਿਪਕਾਰਟ ਤੋਂ ਉਹਨੂੰ ਆਰਡਰ ਕਰ ਦਿੱਤਾ ਅਤੇ ਉਹ ਮੈਨੂੰ ਪੰਜ ਸੱਤ ਦਿਨਾਂ ਦੇ ਵਿੱਚ ਵਿੱਚ ਮੇਰੇ ਘਰ ਆ ਗਿਆ ਅਤੇ ਉੱਥੇ ਮੈਨੂੰ ਪੂਰੇ ਇਹ ਨਹੀਂ ਪੰਜ ਸਾਲ ਦੀ ਗਰੰਟੀ ਵੀ ਮਿਲੀ ਅਤੇ ਮੇਰੀ ਜਿਹੜੀ ਅਸਾਈਨਮੈਂਟ ਜਿਹੜੀ ਮੈਂ ਜਿਸ ਚੀਜ਼ ਲਈ ਮੈਂ ਉਸਨੂੰ ਲਿਆ ਸੀ ਅਤੇ ਮੇਰਾ ਉਹ ਕੰਮ ਵੀ ਆਸਾਨ ਹੋ ਗਿਆ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਆਨਲਾਈਨ ਸ਼ੋਪਿੰਗ ਕਰਕੇ